ਸਾਡੇ ਨੇੜੇ ਇੱਕ ਬਹੁਤ ਹੀ ਧਾਰਮਿਕ ਸਥਾਨ ਹੈ ਜੋ ਕਿ ਸਿੰਘ ਸ਼ਹੀਦਾਂ ਗੁਰਦੁਆਰਾ ਸਾਹਿਬ ਨਾਲ਼ ਪ੍ਰਚਲਿਤ ਹੈ ਜੋ ਕਿ ਸੋਹਾਣਾ ਦੇ ਵਿੱਚ ਸਥਿਤ ਹੈ ਇੱਥੇ ਜਾ ਇੱਥੇ ਅਸੀਂ ਮੱਸਿਆ ਨੂੰ ਪੂਰਨਮਾਸ਼ੀ ਨੂੰ ਅਤੇ ਸੰਗਰਾਂਦ ਨੂੰ ਜਾਂਦੇ ਹਨ ਅਤੇ ਇੱਥੇ ਜਾ ਕੇ ਸਾਨੂੰ ਪਾਠ ਸੁਣਨਾ ਕੀਰਤਨ ਕਰਨਾ ਅਤੇ ਉੱਥੇ ਜਾ ਕੇ ਜੋੜਿਆਂ ਦੀ ਸੇਵਾ ਕਰਨੀ ਜਾ ਭਾਂਡਿਆ ਦੀ ਸੇਵਾ ਕਰਨੀ ਸਭ ਤੋਂ ਵਧੀਆ ਲੱਗਦਾ ਹੈ